ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਤਮੰਨਾ ਬੁਟੀਕ ਤੋਂ ਗੱਲ ਕਰ ਰਹੇ ਹੋ ਓਕੇ ਮੈਂ ਨਾ ਮੋਹਾਲੀ ਵਿੱਚ ਨਵੀਂ ਨਵੀਂ ਆਈ ਹਾਂ ਅਤੇ ਮੈਨੂੰ ਇੱਥੇ ਦਾ ਕੁਝ ਜ਼ਿਆਦਾ ਪਤਾ ਨਹੀਂ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਸੁਜੈਸਟ ਕੀਤਾ ਸੀ ਮੈਨੂੰ ਅਤੇ ਸਾਡੇ ਨਾ ਫੈਮਲੀ ਫੰਕਸ਼ਨ ਆ ਰਹੇ ਆ ਮੈਨੂੰ ਉਹਦੇ ਲਈ ਸੂਟ ਸਵਾਣੇ ਸੀ ਪੰਜਾਬੀ ਸੂਟ ਅਤੇ ਤੁਸੀਂ ਉਹ ਸੀਦੋਗੇ

ਮੈਨੂੰ ਪਿਓਰ ਪੰਜਾਬੀ ਸਲਵਾਰ ਸੂਟ ਚਾਹੀਦੇ ਨੇ ਮੈਂ ਜਿੱਦਾਂ ਜਿੱਦਾਂ ਦੇ ਡਿਜ਼ਾਇਨ ਵਗੈਰਾ ਤੁਹਾਨੂੰ ਦੱਸਾਂਗੀ ਤੁਸੀਂ ਉਦਾਂ ਦਾ ਸੀਦੋਗੇ ਠੀਕ ਹੈ ਜੀ ਅਤੇ ਸਿਲਾਈ ਕਿੰਨੀ ਲੈਂਦੇ ਹੋ ਤੁਸੀਂ ਅਤੇ ਕੁਝ ਡਿਸਕਾਊਂਟ ਵਗੈਰਾ ਹਾਂਜੀ ਅਤੇ ਮੈਂ ਇਹ ਪੁੱਛਣਾ ਸੀ ਕਿ ਤੁਹਾਡਾ ਬੁਟੀਕ ਦੀ ਜੇ ਟਾਈਮਿੰਗ ਹੈ ਉਹ ਕੀ ਕੀ ਹੈ ਅਤੇ ਕਿੱਥੇ ਆ ਤੁਹਾਡਾ ਬਟੀਕ ਅਤੇ ਟਾਈਮਿੰਗ ਕੀ ਟਾਈਮਿੰਗ ਕੀ ਰਹਿੰਦੀ ਹੈ ਠੀਕ ਹੈ ਜੀ ਅਤੇ ਮੈਂ ਫੁਲਕਾਰੀ ਵੀ ਥੋੜ੍ਹੀ ਇਮਬਰੋਇਡਰੀ ਕਰਵਾਉਣੀ ਸੀ ਤੁਸੀਂ ਇਹ ਕੰਮ ਵੀ ਕਰਦੋਗੇ ਠੀਕ ਹੈ ਜੀ ਹਾਂਜੀ ਤੁਸੀਂ ਮੈਨੂੰ ਆਪਣਾ ਅਡਰੈੱਸ ਹੈ ਉਹ ਤੁਹਾਡਾ ਵਟਸਐਪ ਕਰ ਦਿਓ ਅਤੇ ਮੈਂ ਵਜੀਟ ਕਰ ਜਾਵਾਂਗੀ ਠੀਕ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ